ਤੁਹਾਨੂੰ ਸਭ ਨੂੰ ਪਤਾ ਹੈ ਕਿ ਡਾਂਸ ਇੱਕ ਕਲਾ ਹੈ ਜੋ ਕਿ ਅੱਜ ਕੱਲ੍ਹ ਦੇ ਸਮੇਂ ਵਿੱਚ ਇੱਕ ਪੜ੍ਹਾਈ ਦੇ ਤੌਰ 'ਤੇ ਵੀ ਬਣ ਚੁੱਕੀ ਹੈ ਡਾਂਸ ਕਰਨ ਨਾਲ ਸਰੀਰ ਵਿੱਚ ਚੰਨ ਤੰਦਰੁਸਤੀ ਤਾਂ ਆਉਂਦੀ ਹੈ ਅਤੇ ਇਹ ਡਾਂਸ ਕਰਨ ਨਾਲ ਯਾਦਗਾਰੀ ਬਣਾ ਬਣ ਜਾਂਦੀ ਹੈ ਕਿਉਂਕਿ ਜਿਸ ਸਕੂਲ ਦੇ ਸਮੇਂ ਵਿੱਚ ਜਦੋਂ ਅਸੀਂ ਬੱਚੇ ਹੁੰਦੇ ਹਾਂ ਤਾਂ ਅਸੀਂ ਕਿਸੇ ਪ੍ਰੋਗਰਾਮ ਵਿੱਚ ਭਾਗ ਲਿਆ ਹੁੰਦਾ ਹੈ ਤਾਂ ਉੱਥੇ ਅਸੀਂ ਆਪਣਾ ਡਾਂਸ ਪ੍ਰਦਰਸ਼ਨ ਕਰਦੇ ਹਾਂ ਅਤੇ ਓ ਉੱਥੇ ਯਾਦਗਾਰੀ ਲਈ ਫੋਟੋਆਂ ਖਿੱਚੀਆਂ ਜਾਂਦੀਆਂ ਹਨ ਅਤੇ ਵੀਡੀਓ ਰਿਕਾਰਡ ਕੀਤੀ ਜਾਂਦੀ ਹੈ ਜੋ ਕਿ ਬੱਚਿਆਂ ਨੂੰ ਬਾਅਦ ਵਿੱਚ ਦਿਖਾਈ ਜਾਂਦੀ ਹੈ ਤਾਂ ਬੱਚੇ ਆਪਣੀ ਯਾਦ ਨੂੰ ਤਾਜ਼ਾ ਕਰਦੇ ਹਨ ਜਿੱਦਾਂ ਕਿ ਡਾਂਸ ਛੋਟੇ ਹੁੰਦੇ ਤੋਂ ਹੀ ਬੱਚਿਆਂ ਦੇ ਮਨ ਵਿੱਚ ਉਤਰ ਜਾਂਦਾ ਹੈ ਛੋਟੇ ਛੋਟੇ ਬੱਚੇ ਡਾਂਸ ਨੂੰ ਬਹੁਤ ਹੀ ਜ਼ਿਆਦਾ ਪਸੰਦ ਕਰਦੇ ਹਨ ਕਿਸੇ ਵੀ ਤਿਉਹਾਰ 'ਤੇ ਕਿਸੇ ਵੀ ਫੰਕਸ਼ਨ 'ਤੇ ਆਪਾਂ ਡਾਂਸ ਜ਼ਰੂਰ ਕਰਦੇ ਹਾਂ ਵਿਆਹ ਸ਼ਾਦੀਆਂ 'ਤੇ ਵੀ ਡਾਂਸ ਕਰਦੇ ਹਾਂ ਕੋਈ ਪ੍ਰੋਗਰਾਮ ਹੁੰਦਾ ਹੈ ਤਾਂ ਵੀ ਡਾਂਸ ਕਰਦੇ ਹਾਂ ਤਿਉਹਾਰਾਂ 'ਤੇ ਵੀ ਅਸੀਂ ਡਾਂਸ ਕਰਦੇ ਹਾਂ ਕਿਸੇ ਬੱਚੇ ਦੀ ਪਹਿਲੀ ਲੋਹੜੀ ਹੋਲੀ ਹੋਵੇ ਤਾਂ ਵੀ ਆਪਾਂ ਡਾਂਸ ਕਰਦੇ ਹਾਂ ਯਾਦਗਾਰੀ ਇੱਕ ਪਲ ਦੀ ਹੁਨ ਕੁਝ ਪਲ ਦੀ ਹੁੰਦੀ ਹੈ ਜਿੱਦਾਂ ਕੀ ਡਾਂਸ ਕਰਦੇ ਦੀ ਵੀਡੀਓ ਰਿਕਾਰਡ ਟੇਪ ਰਿਕਾਰਡ ਹੋ ਕੀਤੀ ਜਾਂਦੀ ਹੈ ਤਾਂ ਉਹ ਜਦੋਂ ਕੁਝ ਸਮੇਂ ਬਾਅਦ ਆਪਣੀ ਉਹ ਵੀਡੀਓ ਟੇਪ ਰਿਕਾਰਡ ਨੂੰ ਦੇਖਦਾ ਹੈ ਤਾਂ ਉਹਨੂੰ ਉਸਦਾ ਸਮਾਂ ਪੁਰਾਣਾ ਯਾਦ ਆਉਂਦਾ ਹੈ